ਮੈਂ ਆਪਣਾ ਬਿਜਲੀ ਦਾ ਬਿੱਲ ਭਰਿਆ ਪਰ ਸਾਈਟ 'ਤੇ ਸ਼ੋਅ ਨਹੀਂ ਹੋ ਰਿਹਾ ਕਿ ਮੈਂ ਭਰਿਆ ਮੈਂ ਆਪਣਾ ਬਿਜਲੀ ਦਾ ਬਿੱਲ ਓਨਲਾਈਨ ਭਰਿਆ ਹੈ ਗੂਗਲ ਪੇ ਵਿੱਚ ਜਾ ਕੇ ਪੇਮੈਂਟਸ 'ਚੋਂ ਕੱਢਿਆ ਸੀਗਾ ਅਤੇ ਮੈਂ ਉਹਦਾ ਸਕਰੀਨਸ਼ੋਟ ਵੀ ਲੈ ਕੇ ਰੱਖ ਲਿਆ ਹੈ ਜੇਕਰ ਤੁਹਾਨੂੰ ਐ ਲੱਗਦਾ ਹੈ ਕਿ ਮੈਂ ਬਿਲ ਨਹੀਂ ਭਰਿਆ ਮੈਂ ਜਾਣ ਕੇ ਕਹਿ ਰਿਹਾ ਹਾਂ ਤਾਂ ਤੁਹਾਨੂੰ ਮੈਂ ਸਕਰੀਨਸ਼ੋਟ ਵੀ ਸ਼ੇਅਰ ਕਰ ਦਿੰਦਾ ਹਾਂ ਇਹ ਟੈਕਨੀਕਲ ਪ੍ਰੋਬਲਮ ਹੋ ਸਕਦੀ ਹੈ ਜਾਂ ਕੋਈ ਤੁਹਾਡੀ ਕੰਪਨੀ 'ਚ ਇਸ਼ੂ ਹੋ ਸਕਦਾ ਹੈ ਕਿਰਪਾ ਕਰਕੇ ਮੈਨੂੰ ਫਾਈਨ ਨਾ ਲਗਾਇਆ ਜਾਵੇ ਜੇਕਰ ਮੈਨੂੰ ਫਾਈਨ ਲਗਾਇਆ ਜਾਂਦਾ ਹੈ ਤਾਂ ਮੈਂ ਸਰਕਾਰ ਨੂੰ ਨੋਟਿਸ ਲਿਖਾਂਗਾ ਅਤੇ ਤੁਹਾਡੇ ਦੁਆਰਾ ਸਟਰੀਕਟ ਐਕਸ਼ਨ ਲੈਣ ਦਾ ਵੀ ਕਹਾਂਗਾ